ਸਾਡੇ ਖੇਤਰ ਵਿੱਚ ਸਭ ਧਰਮਾਂ ਦੇ ਲੋਕ ਆਪਣੇ ਆਪਣੇ ਧਾਰਮਿਕ ਸਮਾਗਮ ਜਿਵੇਂ ਕਿ ਗੁਰਪੁਰਬ ਜਗਰਾਤੇ ਅਤੇ ਰਾਮਲੀਲਾ ਆਦਿ ਸਭ ਮਿਲ ਜੁਲ ਕੇ ਵੱਡੇ ਪੱਧਰ 'ਤੇ ਕਰਦੇ ਹਨ